ਸਾਡੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੂੰ ਕਿ ਅਸੀਂ ਪਿਛਲੇ ਸਮੇਂ ਕਾਫੀ ਸਮੇਂ ਤੋਂ ਜਾਣਦੇ ਹਾਂ ਉਹਨਾਂ ਨੇ ਆ ਕੇ ਬਹੁਤ ਹੀ ਅੱਛੇ ਕੰਮ ਕੀਤੇ ਜਿਵੇਂ ਕਿ ਨਸ਼ਾ ਬਹੁਤ ਜ਼ਿਆਦਾ ਕੰਟਰੋਲ 'ਚ ਕੀਤਾ ਨੌਜਵਾਨੀ ਨੂੰ ਬਹੁਤ ਜ਼ਿਆਦਾ ਸੇਧ ਦਿੱਤੀ ਸੇਧ ਦੇਣ ਦੇ ਨਾਲ ਨਾਲ ਨਵੀਂ ਜੋ ਪੀੜ੍ਹੀ ਸਾਡੀ ਬਿਨਾ ਬੇਰੁਜ਼ਗਾਰ ਸੀ ਉਹਨਾਂ ਨੂੰ ਰੁਜ਼ਗਾਰ ਦਿੱਤਾ ਬਹੁਤ ਜ਼ਿਆਦਾ ਸਰਕਾਰੀ ਨੌਕਰੀਆਂ ਦੋ ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਫੇਰ ਉਹਨਾਂ ਨੇ ਨਵੇਂ ਟੀਚੇ ਬਹੁਤ ਅੱਛੇ ਅੱਛੇ ਨਵੇਂ ਟੀਚੇ ਰੱਖੇ ਹੈ ਜੋ ਆਉਣ ਵਾਲੇ ਸਮੇਂ 'ਚ ਲਾਗੂ ਕਰਨਗੇ ਉਸ ਤੋਂ ਬਾਅਦ ਕੁਛ ਨਵੀਆਂ ਬੱਸਾਂ ਜੋ ਉਹਨਾਂ ਨੇ ਪ੍ਰਚੇਸ ਕਰਕੇ ਪੰਜਾਬ ਦੀਆਂ ਸੜਕਾਂ 'ਤੇ ਚਲਾਈਆਂ ਜਿਨ੍ਹਾਂ ਕਾਰਨ ਜੋ ਸਾਡੀਆਂ ਇਸਤਰੀਆਂ ਔਰਤਾਂ ਹਨ ਉਹਨਾਂ ਨੂੰ ਉਹਨਾਂ ਦੇ ਵਿੱਚ ਫ੍ਰੀ ਸਫ਼ਰ ਕਰਨ ਦਾ ਮੌਕਾ ਵੀ ਦਿੱਤਾ ਜਾਂਦਾ ਹੈ